ਸਾਡੇ ਭਰਾ ਨੇ ਰੀਤੀ ਰਿਵਾਜ਼ਾਂ ਅਨੁਸਾਰ ਭੋਜਨ ਪਕਾਉਣ ਤੋਂ ਪਹਿਲਾਂ ਇਹ ਅੰਧ ਵਿਸ਼ਵਾਸ ਪ੍ਰਚਲਿੱਤ ਸੀ ਕਿ ਪੁਰਾਣੇ ਸਮਿਆਂ ਵਿੱਚ ਵੀ ਔਰਤ ਨਹਾ ਕੇ ਹੀ ਰਸੋਈ ਵਿੱਚ ਜਾਵੇ ਜੋ ਕਿ ਅੰਧ ਵਿਸ਼ਵਾਸ ਸੀ ਅਤੇ ਅਸੀਂ ਪੰਜਾਬ ਦੇ ਲੋਕ ਜਿਹੜੇ ਸਿੱਖ ਧਰਮ ਨੂੰ ਮੰਨਦੇ ਹਾਂ ਸਾਡੇ ਸਿੱਖ ਧਰਮ ਵਿੱਚ ਇਹ ਹੀ ਸਿਖਾਇਆ ਜਾਂਦਾ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਅਰਦਾਸ ਕੀਤੀ ਜਾਵੇ ਜਾਂ ਸ਼ੁਕਰਾਨਾ ਕੀਤਾ ਜਾਵੇ ਸਾਡੇ ਸਿੱਖ ਧਰਮ ਵਿੱਚ ਇਹ ਹੀ ਪਰੰਪਰਾ ਪ੍ਰਚਲਿੱਤ ਹੈ ਜੋ ਅਸੀਂ ਰੋਜ਼ ਖਾਣਾ ਖਾਣ ਤੋਂ ਪਹਿਲਾਂ ਅਰਦਾਸ ਕਰਦੇ ਹਾਂ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਸਾਨੂੰ ਜੋ ਕੁਝ ਦਿੱਤਾ ਉਹ ਤੇਰਾ ਦਿੱਤਾ ਹੀ ਹੈ ਇਸ ਤਰ੍ਹਾਂ ਦੀਆਂ ਪ੍ਰੰਪਰਾਵਾਂ ਪ੍ਰਚਲਿੱਤ ਹਨ